ਜੀ ਹਾਂ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਬਿਲਕੁਲ ਨਿਰਭਰ ਕਰਦੀ ਹੈ ਜਿਵੇਂ ਕਿ ਸਾਡੇ ਹੁਣ ਦੇ ਜ਼ਮਾਨੇ 'ਚ ਸਾਡੇ ਬਥੇਰੇ ਕੰਮ ਨੇ ਜਿਹੜੇ ਬਿਜਲੀ ਦੇ ਨਾਲ ਨਾਲ ਹੀ ਹੁੰਦੇ ਨੇ ਤਾਂ ਉਹ ਕੰਮ ਅਧੂਰੇ ਵੀ ਰਹਿ ਜਾਂਦੇ ਨੇ ਜੇਕਰ ਬਿਜਲੀ ਨਾ ਹੋਵੇ ਅਤੇ ਬਿਜਲੀ ਦਾ ਨਾ ਹੋਣਾ ਵੀ ਮਾੜਾ ਪ੍ਰਭਾਵ ਪੈਂਦਾ ਹੈ ਸਾਡੇ 'ਤੇ ਜਿਵੇਂ ਕਈ ਫੈਕਟਰੀਆਂ ਵਿੱਚ ਮਸ਼ੀਨਾਂ ਨੇ ਜਿਹੜੀ ਸਿਰਫ਼ ਬਿਜਲੀ 'ਤੇ ਹੀ ਚੱਲਦੀਆਂ ਨੇ ਅਤੇ ਉਹ ਬਿਜਲੀ ਦੇ ਨਾ ਹੋਣ ਦੇ ਕਾਰਨ ਸਾਡੀ ਕਈ ਮਸ਼ੀਨਾਂ ਦਾ ਕੰਮ ਨਹੀਂ ਹੋ ਪਾਉਂਦਾ ਅਤੇ ਉਹ ਜਿਹੜੇ ਕਰਮਚਾਰੀ ਹੁੰਦੇ ਨੇ ਅਤੇ ਉਹ ਆਪਣੀ ਰੋਜ਼ੀ ਰੋਟੀ ਵੀ ਨਹੀਂ ਕਮਾ ਪਾਉਂਦੇ ਅਤੇ ਇਸ ਲਈ ਇਹਦੇ ਲਈ ਬਿਜਲੀ ਲਈ ਬਹੁਤ ਬਿਜਲੀ ਦੇ ਕਈ ਵਿਕਲਪ ਕੱਢੇ ਨੇ ਜਿਵੇਂ ਕਿ ਪਹਿਲੇ ਦੇ ਜ਼ਮਾਨੇ 'ਚ ਇੱਥੇ ਬੰਦੇ ਦੀਏ ਵਗੈਰਾ ਬਾਲ ਲੈਂਦੇ ਨੇ ਨੇ ਲਾਲਟੈਨ ਵਗੈਰਾ ਯੂਸ ਕਰਦੇ ਰਹੇ ਨੇ ਹੁਣ ਉਹਦੇ 'ਚ ਓ ਓਹਨੂੰ ਹਟਾ ਕੇ ਨਏ ਨਏ ਵਿਕਲਪ ਯੂਸ ਇਸਤੇਮਾਲ ਕੀਤੇ ਜਾਂਦੇ ਨੇ ਜਿਵੇਂ ਕਿ ਟੋਰਚ ਵਗੈਰਾ ਹੋ ਗਿਆ ਔਰ ਲਾਈਟਾਂ ਵਗੈਰਾ ਹੋ ਗੀਆਂ ਇਨਵਰਟਰ ਵਗੈਰਾ ਹੋ ਗਿਆ ਇਹ ਵਿਕਲਪਾਂ ਨੂੰ ਇਸਤੇਮਾਲ ਕਰਕੇ ਬੰਦਾ ਆਪਣੇ ਵੀ ਵਿਕਲਪਾਂ ਨੂੰ ਇਸਤੇਮਾਲ ਕਰਕੇ ਅਸੀਂ ਆਪਣੇ ਕੰਮ ਅੱਗੇ ਕਢਾ ਸਕਦੇ ਨੇ ਬਿਜਲੀ ਦੇ ਨਾ ਹੋਣ ਦੇ ਕਾਰਨ ਅਸੀਂ ਇਹ ਵਿਕਲਪਾਂ ਨੂੰ ਇਸਤੇਮਾਲ ਕਰਦੇ ਹਨ ਪਰ ਉਂਝ ਵੀ ਕਈ ਲੋਕਾਂ ਦੇ ਘਰ ਹਾਲੇ ਵੀ ਇਨਵਰਟਰ ਵਗੈਰਾ ਨਹੀਂ ਨੇ ਅਤੇ ਇਸ ਇਹ ਵੀ ਇੱਕ ਬਹੁਤ ਵੱਡਾ ਸ ਬਹੁਤ ਵੱਡਾ ਮ ਬਹੁਤ ਵੱਡੀ ਮਜਬੂਰੀ ਹੈ ਅਤੇ ਇਨਵਟਰ ਦੇ ਹੋਣ ਦੇ ਨਾਲ ਨਾਲ ਇਨਵਟਰ ਜਿੱਦਾਂ